ਕੱਤੀ ਮਾਰਚ ਦੋ ਹਜ਼ਾਰ ਤਿੰਨ ਚਾਰ ਅਪ੍ਰੈਲ ਦੋ ਹਜ਼ਾਰ ਦੋ ਸਤਾਰ੍ਹਾਂ ਅਪ੍ਰੈਲ ਦੋ ਹਜ਼ਾਰ ਦੋ ਚਾਰ ਦਸੰਬਰ ਦੋ ਹਜ਼ਾਰ ਤਿੰਨ ਛੇ ਨਵੰਬਰ ਦੋ ਹਜ਼ਾਰ ਦੋ